ਮੈਂ ਰਾਜਕੁਮਾਰ ਰੈਲ ਮਾਜਰੇ ਤੋਂ ਤੁਹਾਡੀ ਔਨਲਾਈਨ ਸ਼ੋਪ ਤੋਂ ਇੱਕ ਲੈਦਰ ਦੀ ਜੈਕਟ ਅਤੇ ਬੂਟ ਆਡਰ ਕੀਤੇ ਸੀ ਅੱਜ ਪੰਦਰਾਂ ਦਿਨ ਪਹਿਲੇ ਮੈਨੂੰ ਅਜੇ ਤੱਕ ਮਿਲੇ ਨਹੀਂ ਜਦੋਂ ਔਨਲਾਈਨ ਚੈੱਕ ਕਰਦਾ ਹਾਂ ਤਾਂ ਚੈੱਕ ਕਰਨ 'ਤੇ ਡਿਲੀਵਰ ਦਿਖਾ ਰਿਹਾ ਹੈ ਪਰ ਇਹ ਮੈਨੂੰ ਮੇਰੇ ਹਲੇ ਤੱਕ ਪ੍ਰਾਪਤ ਨਹੀਂ ਹੋਏ ਕਿਉਂਕਿ ਮੈਂ ਵਿਆਹ ਦੇਖਣਾ ਸੀ ਇਸ ਕਾਰਨ ਮੈਂ ਔਡਰ ਕੀਤੇ ਸੀ ਮੈਨੂੰ ਮੇਰੇ ਕੀਤੇ ਔਨਲਾਈਨ ਔਡਰ ਨੂੰ ਪ੍ਰਾਪਤ ਕਰਨ ਬਾਰੇ ਮਦਦ ਕਰੋ ਮੈਂ ਇਸ ਕਾਰਨ ਇਸਨੂੰ ਖਰੀਦ ਨਹੀਂ ਸਕਿਆ ਕਿਰਪਾ ਕਰਕੇ ਮੇਰਾ ਔਡਰ ਮੇਰੇ ਤੱਕ ਪਹੁੰਚਾਇਆ ਜਾਵੇ ਮੈਂ ਆਪ ਜੀ ਦਾ ਬਹੁਤ ਹੀ ਦਿਲੋਂ ਧੰਨਵਾਦੀ ਹੋਵਾਂਗਾ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰਾ ਆਡਰ ਮੇਰੇ ਤੱਕ ਪਹੁੰਚਾਇਆ ਜਾਵੇ ਸੋ ਥੈਂਕ ਯੂ